ਕੁਛ ਆਮ ਗਤੀਵਿਧੀਆਂ ਜਿਵੇਂ ਕਿ ਬਲਦਾਂ ਦੀਆਂ ਦੌੜਾਂ ਕਬੱਡੀ ਜਰਗ ਦਾ ਮੇਲਾ ਗੱਤਕਾ ਕਬੂਤਰਾਂ ਦੀ ਬਾਜ਼ੀ ਆਦਿ ਅਤੇ ਸੈ ਸੈਰ ਸਪਾਟਾ ਅਤੇ ਆਰਾਮ ਦੇ ਵਿੱਚ ਸਟੇਡੀਅਮ ਅਤੇ ਪਾਰਕ